ਸਤਿ ਸ਼੍ਰੀ ਅਕਾਲ ਜੀ ਅਸੀਂ ਤਕਰੀਬਨ ਉੱਨੀ ਸਾਲ ਦੀ ਉਮਰ ਤੋਂ ਅਸੀਂ ਆਰਮੀ ਦੇ ਵਿੱਚ ਜੋਈਨਿੰਗ ਕੀਤੀ ਔਰ ਉਸ ਤੋਂ ਬਾਅਦ ਤਕਰੀਬਨ ਤਕਰੀਬਨ ਬਾਈ ਸਾਲ ਦੀ ਸਰਵਿਸ ਕਰਕੇ ਅਸੀਂ ਫ਼ੌਜ ਦੇ ਵਿਚੋਂ ਰਿਟਾਇਰ ਹੋਏ ਔਰ ਰਿਟਾਇਰ ਹੋਣ ਤੋਂ ਬਾਅਦ ਹਰ ਇੱਕ ਇਨਸਾਨ ਇਹ ਚਾਹੁੰਦਾ ਕਿ ਮੇਰਾ ਕਿਤੇ ਨਾ ਕਿਤੇ ਕੋਈ ਹਲਕੀ ਫੁਲਕੀ ਜੌਬ ਔਰ ਮੇਰਾ ਟਾਈਮ ਪਾਸ ਹੋਵੇ ਔਰ ਜੋ ਕਿ ਦਿਨ ਦੀ ਰੁਟੀਨ ਨੂੰ ਸਹੀ ਰੱਖਦਾ ਹੈ ਤਕਰੀਬਨ ਤਕਰੀਬਨ ਸਾਨੂੰ ਚਾਰ ਸਾਲ ਹੋ ਗਏ ਨੇ ਅਸੀਂ ਸਕਿਊਰਿਟੀ ਸੁਪਰਵਾਈਜ਼ਰ ਦੀ ਡਿਊਟੀ ਕਰ ਰਹੇ ਹਾਂ ਲੇਕਿਨ ਉਸ ਦੇ ਦੌਰਾਨ ਹੀ ਸਾਨੂੰ ਇੱਕ ਨਵੀਂ ਆਪੋਰਚੁਨਿਟੀ ਮਿਲੀ ਜੋ ਕਿ ਕ੍ਰਿਪਟੋ ਕਰੰਸੀ ਜੋ ਕਿ ਚੇਂਜ ਹੋ ਕੇ ਐੱਨ ਐੱਫ਼ ਟੀ ਔਰ ਮੈਟਾਵਰਸ ਦੇ ਵਿੱਚ ਜਾ ਰਹੀ ਹੈ ਔਰ ਜੋ ਕਿ ਅੱਜ ਦਾ ਯੁੱਗ ਹੈ ਇੰਟਰਨੈਟ ਦਾ ਯੁੱਗ ਹੈ ਹਰ ਇੱਕ ਸਮਾਨ ਅਸੀਂ ਔਨਲਾਈਨ ਮੰਗਵਾ ਰਹੇ ਹਾਂ ਔਨਲਾਈਨ ਹੀ ਪੇਮੈਂਟਾਂ ਹੋ ਰਹੀਆਂ ਹਨ ਔਰ ਮੈਟਾਵਰਸ ਇੱਕ ਐਸੀ ਚੀਜ਼ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦੇ ਉੱਤੇ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ ਕਿ ਕੋਰਟ ਕਚਹਿਰੀਆਂ ਫੈਕਟਰੀਆਂ ਔਰ ਡਾਕਟਰ ਦੀ ਐਪੋਇੰਟਮੈਂਟ ਇੱਥੇ ਤੱਕ ਕਿ ਸਾਨੂੰ ਬੈਂਕ ਜਾਣ ਦੀ ਵੀ ਜ਼ਰੂਰਤ ਨਹੀਂ ਪਏਗੀ ਔਰ ਸਾਡੇ ਜੋ ਬੱਚੇ ਹਨ ਜਿਵੇਂ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਬੇਟੀ ਹੈ ਸਾਨੂੰ ਬਾਹਰ ਭੇਜਣਾ ਮੁਸ਼ਕਿਲ ਹੈ ਪੜ੍ਹਾਉਣ ਵਾਸਤੇ ਅਸੀਂ ਇਸ ਟੈਕਨੋਲਜੀ ਦੇ ਮਾਧਿਅਮ ਰਾਹੀਂ ਵੱਧ ਤੋਂ ਵੱਧ ਇਸਦਾ ਫਾਇਦਾ ਚੁੱਕ ਕੇ ਅਸੀਂ ਆਪਣੇ ਬੱਚਿਆਂ ਨੂੰ ਘਰ ਬੈਠ ਕੇ ਹੀ ਜੋ ਅੱਜ ਦੀ ਪੜ੍ਹਾਈ ਹੈ ਉਹ ਅਸੀਂ ਉਪਲਬਧ ਕਰਾ ਸਕਦੇ ਹਾਂ ਔਰ ਅਸੀਂ ਇਸ ਮਾਧਿਅਮ ਰਾਹੀਂ ਅਰਨਿੰਗ ਔਰ ਸਿੱਖ ਕੇ ਔਰ ਜਿੰਨਾਂ ਮਰਜ਼ੀ ਅਸੀਂ ਆਪਣੀ ਪੈਸਾ ਕਮਾ ਸਕਦੇ ਹਾਂ ਜਿਸ ਦੇ ਵਿੱਚ ਸਾਨੂੰ ਕਿਸੇ ਵੀ ਇਨਸਾਨ ਦੇ ਦੁਆਰਾ ਕੋਈ ਵੀ ਧੋਖਾ ਫਰੇਬ ਹੋਣ ਦਾ ਕੋਈ ਵੀ ਡਰ ਨਹੀਂ ਹੈ ਔਰ ਨਾ ਹੀ ਇਹ ਕਿਸੇ ਇਨਸਾਨ ਦੇ ਹੱਥ ਵਿੱਚ ਹੈ ਇਹ ਇੱਕ ਟੈਕਨੋਲੋਜੀ ਹੈ ਜ਼ਰੂਰੀ ਹੈ ਕਿ ਸਾਨੂੰ ਹਰ ਇੱਕ ਬੰਦੇ ਨੂੰ ਅਪਣਾਉਣੀ ਚਾਹੀਦੀ ਹੈ ਸਾਡਾ ਪੈਸਾ ਹੈ ਜੋ ਉਸ ਦਾ ਸਹੀ ਮੁੱਲ ਸਾਨੂੰ ਕਈ ਗੁਣਾ ਗਰੋਥ ਦੇ ਸਕਦਾ ਹੈ ਔਰ ਦੇ ਵੀ ਰਿਹਾ ਹੈ ਔਰ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਧੋਖਾ ਫ਼ਰੇਬ ਹੋਣ ਦਾ ਕੋਈ ਡਰ ਨਹੀਂ ਔਰ ਅਸੀਂ ਫਿਊਚਰ ਦੇ ਵਿੱਚ ਜੋ ਵੀ ਕੰਮ ਕਰਨਾ ਹੈ ਉਹਦਾ ਸਾਨੂੰ ਆਸਾਨੀ ਰਹੇਗੀ ਔਰ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਹੈੱਡਏਕ ਨਹੀਂ ਰਹੇਗੀ ਧੰਨਵਾਦ ਜੀ